ਪਰੰਪਰਾਗਤ ਮੌਕਿਆਂ ਉਤੇ ਨੱਚਣ ਵਾਲੇ ਨਾਚ ਸਾਡੇ ਪੰਜਾਬ ਵਿੱਚ ਮੁੱਖ ਤੌਰ 'ਤੇ ਗਿੱਧਾ ਅਤੇ ਭੰਗੜਾ ਹੈ ਪਰੰਪਰਾਗਤ ਮੌਕਿਆ ਉੱਤੇ ਇਹ ਬਹੁਤ ਹੀ ਧੂਮ ਧਾਮ ਨਾਲ ਪਾਇਆ ਜਾਂਦਾ ਹੈ ਮੁਟਿਆਰਾਂ ਅਤੇ ਗੱਭਰੂਆਂ ਇਹਨਾਂ ਦੀ ਸ਼ਾਨ ਵਧਾ ਦਿੰਦੇ ਹਨ ਮੁਟਿਆਰਾਂ ਆਪਣੇ ਗਿੱਧੇ ਵਿੱਚ ਸਲਵਾਰ ਸੂਟ ਕੈਂਠਾ ਸੱਗੀ ਫੁੱਲ ਵਾਲ਼ੀਆਂ ਚੂੜੀਆਂ ਪਰਾਂਦਾ ਝਾਂਜਰਾਂ ਜੁੱਤੀ ਆਦਿ ਇਹ ਪਾ ਕੇ ਗਿੱਧਾ ਪਾਉਂਦੀਆਂ ਹਨ ਅਤੇ ਬਹੁਤ ਹੀ ਧੂਮ ਧਾ ਧੂਮ ਮਚਾ ਦਿੰਦੀਆਂ ਹਨ ਅਤੇ ਗੱਭਰੂਆਂ ਦੀ ਗੱਲ ਕਰੀਏ ਤਾਂ ਗੱਭਰੂ ਕੁੜ੍ਹਤਾ ਚਾਦਰਾ ਕੈਂਠਾ ਕੈਂਠਾ ਆਦਿ ਪਾ ਕੇ ਭੰਗੜੇ ਦੀ ਸ਼ਾਨ ਵਧਾ ਦਿੰਦੇ ਹਨ ਧੰਨਵਾਦ